ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜੋ ਕਿ ਘੁੰਮਣ ਯੋਗ ਨਾਲ਼ ਨਾਲ਼ ਇਤਿਹਾਸਿਕ ਵੀ ਹਨ ਜਿਵੇਂ ਕਿ ਤਾਜ ਮਹਿਲ ਫਤਿਹਗੜ੍ਹ ਸਾਹਿਬ ਪਟਿਆਲਾ ਕੁੱਲੂ ਮਨਾਲੀ ਅਤੇ ਸ਼ਿਮਲਾ ਹੋਰ ਵੀ ਬਹੁਤ ਸਾਰੀਆਂ ਹਨ ਤਾਜ ਮਹਿਲ ਆਪਣੀ ਸੁੰਦਰਤਾ ਦੇ ਕਾਰਨ ਬਹੁਤ ਹੀ ਮਸ਼ਹੂਰ ਹੈ ਜਿੱਥੇ ਮੈਂ ਦੋ ਵਾਰ ਗਿਆ ਹਾਂ ਅਤੇ ਫਤਿਹਗੜ੍ਹ ਸਾਹਿਬ ਜੋ ਕਿ ਲੋਕਲ ਹੀ ਪੈਂਦਾ ਹੈ ਅਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਪੁੱਤਰ ਸ਼ਹੀਦ ਹੋਏ

ਜਿਹਨਾਂ ਦੇ ਇਤਿਹਾਸ ਨਾਲ਼ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ